ਘਰ ਵਿੱਚ ਬਿਜਲੀ ਦੇ ਕਿੰਨੇ ਘੰਟੇ ਤਾਂ ਗਿਣਨੇ ਜਿਹੜੇ ਔਖੇ ਹੀ ਹੈ ਕਿਉਂਕਿ ਵਾਧੂ ਘੰਟੇ ਤਾਂ ਬਿਜਲੀ ਆਉਂਦੀ ਨਹੀਂ ਹੈ ਔਰ ਜਿਹੜੇ ਗਰਮੀ ਦੇ ਮੌਸਮ ਵਿੱਚ ਤਾਂ ਬਿਲਕੁਲ ਜਦੋਂ ਇਹਦੀ ਜਿਆਦਾ ਲੋੜ ਹੁੰਦੀ ਹੈ ਉਦੋਂ ਤਾਂ ਬਿਲਕੁਲ ਹੀ ਨਹੀਂ ਆਉਂਦੀ ਹੈ ਹੋਰ ਮੌਸਮਾਂ ਵਿੱਚ ਵੀ ਠੀਕ ਠਾਕ ਹੀ ਰਹਿੰਦਾ ਏ ਅਤੇ ਬਾਰਿਸ਼ਾਂ ਦੇ ਮੌਸਮ 'ਚ ਵੀ ਬੜਾ ਤੰਗ ਹੁੰਦੇ ਹਾਂ ਥੋੜ੍ਹੀ ਜਿਹੀ ਬਾਰਿਸ਼ ਹੁੰਦੀ ਹੈ ਉਦੋਂ ਹੀ ਬਿਜਲੀ ਦਾ ਵੱਡਾ ਕੱਟ ਲੱਗ ਜਾਂਦਾ ਕਿਤੇ ਕੋਈ ਖੰਭਾ ਟੁੱਟ ਜਾਂਦਾ ਕਿਤੇ ਕੋਈ ਦਰੱਖਤ ਟੁੱਟ ਜਾਂਦਾ ਹੈ ਤਾਰਾਂ ਸਾਰੀਆਂ ਫਸ ਫੁਸ ਜਾਂਦੀਆਂ ਟੁੱਟ ਟੱਟ ਜਾਂਦੀਆਂ ਅਤੇ ਬਿਜਲੀ ਜਿਹੜੀ ਹੈਗੀ ਜ਼ਿਆਦਾ ਮੋਸਟਲੀ ਗਈ ਉਹ ਰਹਿ ਰਹਿੰਦੀ ਹੈ ਅਤੇ ਗਰਮੀਆਂ ਦੇ ਦਿਨਾਂ ਵਿੱਚ ਤਾਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਛੇ ਛੇ ਘੰਟੇ ਕਈ ਵਾਰ ਲਾਈਟ ਨਹੀਂ ਆਉਂਦੀ ਹੈ ਛੇ ਘੰਟੇ ਦਾ ਕੱਟ ਲੱਗ ਕੇ ਵੀ ਕਈ ਵਾਰ ਇੱਕ ਘੰਟਾ ਦੋ ਘੰਟਾ ਲਾਈਟ ਆਉਂਦੀ ਹੈ ਉਸ ਤੋਂ ਬਾਅਦ ਫਿਰ ਚਾਰ ਚਾਰ ਪੰਜ ਪੰਜ ਘੰਟੇ ਲਾਈਟ ਨਹੀਂ ਆਉਂਦੀ ਹੈ ਅਤੇ ਬਹੁਤ ਜ਼ਿਆਦਾ ਕੱਟ ਲੱਗ ਰਹੇ ਆ ਗਰਮੀਆਂ ਦੇ ਵਿੱਚ ਤਾਂ ਅਤੇ ਜ਼ਿੰਦਗੀ ਜ਼ਿੰਦਗੀ ਤਾਂ ਕ ਕੰਮ ਕਿਵੇਂ ਕਰੇਗਾ ਬੰਦਾ ਜੇ ਲਾਈਟ ਹੀ ਨਹੀਂ ਹੋਵੇਗੀ ਅਤੇ ਅੱਜ ਦੀ ਡੇਟ ਵਿੱਚ ਤਾਂ ਅਸੀਂ ਇੰਨੇ ਜਿਹੜੇ ਆਦੀ ਹੋ ਚੁੱਕੇ ਹਾਂ ਬਿਜਲੀ ਦੇ ਕਿ ਉਦੋਂ ਬਿਨਾਂ ਕੰਮ ਹੀ ਨਹੀਂ ਕੋਈ ਹੁੰਦਾ ਕੰਮ ਕ ਕੰਮ ਉਦੋਂ ਹੀ ਹੋਵੇਗਾ ਜੇ ਕੋਈ ਬਿਜਲੀ ਆਵੇਗੀ ਘਰ ਨਾ ਤਾਂ ਪਾਣੀ ਭਰ ਸਕਦੇ ਹਾਂ ਨਾ ਹੀ ਕੋਈ ਆਪਾਂ ਕੋਈ ਇਲੈਕਟ੍ਰੋਨਿਕਸ ਦਾ ਕੰਮ ਕਰ ਸਕਦੇ ਹਾਂ ਕਿਚਨ ਵਿੱਚ ਵੀ ਬਿਜਲੀ ਦੇ ਨਾਲ਼ ਹੀ ਕੰਮ ਚੱਲਦਾ ਹੈ ਹਰ ਥਾਂ 'ਤੇ ਮਤਲਬ ਜੋ ਵੀ ਘਰ ਬੱਚਿਆਂ ਨੂੰ ਸੰਭਾਲਣਾ ਬੱਚਿਆਂ ਨੇ ਵੀ ਬੱਚ ਬਿਜਲੀ ਦੇ ਨਾਲ਼ ਹੀ ਟਿੱਕ ਕੇ ਬੈਠਣਾ ਏ ਅਤੇ ਮਤਲਵ ਪੂਰੀ ਤਰ੍ਹਾਂ ਹੀ ਸਾਰੀ ਲਾਈਫ ਹੀ ਜਿਹੜੀ ਉਹਦੇ ਨਾਲ਼ ਪ੍ਰਭਾਵਿਤ ਹੁੰਦੀ ਹੈ ਜੇ ਲਾਈਟ ਨਹੀਂ ਆਉਂਦੀ ਘਰ ਅਤੇ ਲਾਈਟ ਤਾਂ ਬਹੁਤ ਤੰਗ ਰਹਿੰਦੇ ਹਾਂ